ਬਾਲੀਵੁੱਡ ਫਿਲਮ ਇੰਡਸਟਰੀ ਵਿੱਚ ਇੱਕ ਪੰਜਾਬੀ ਫਿਲਮ ਰੱਬ ਦਾ ਰੇਡੀਓ ਜਿਸ ਵਿੱਚ ਸਿੰਮੀ ਚਾਹਲ ਨੇ ਬਹੁਤ ਸੋਹਣੇ ਸੋਹਣੇ ਸੂ਼ਟ ਪਹਿਨੇ ਹੋਏ ਹਨ ਅਤੇ ਉਸ ਨੇ ਭਾਰੀ ਸਲਵਾਰਾਂ ਅਤੇ ਕਢਾਈ ਵਾਲੇ ਸੂਟ ਪਾਏ ਹੋਏ ਹਨ ਅ ਅਤੇ ਕੰਟਰਾਸ ਸੂ਼ਟ ਬਣਾਏ ਹੋਏ ਸੀ ਇਸ ਕਰਕੇ ਉਸ ਨੂੰ ਦੇਖ ਕੇ ਮੈਂ ਆਪਣੇ ਸੂਟ ਵੀ ਉਵੇਂ ਦੇ ਹੀ ਸਵਾਉਂਦੀ ਹਾਂ ਅਤੇ ਹੋਰ ਸਭ ਦੇ ਸੂਟ ਮੈਂ ਸਿਲਾਈ ਕਰਦੀ ਹਾਂ